ਨਹੀਂ ਮੈਨੂੰ ਮੈਨੂੰ ਪੰਜਾਬੀ ਬੋਲਣ ਜਾਂ ਲਿਖਣ ਵੇਲੇ ਕਦੇ ਕੋਈ ਮੁਸ਼ਕਲ ਨਹੀਂ ਆਈ ਕਿਉਂਕਿ ਮੇਰਾ ਜਨਮ ਪੰਜਾਬ ਦੇ ਜ਼ਿਲ੍ਹੇ ਨਵਾਂਸ਼ਹਿਰ ਦੇ ਛੋਟੇ ਜਿਹੇ ਪਿੰਡ ਵਿੱਚ ਹੋਇਆ ਅਤੇ ਮੇਰਾ ਜਿਹੜਾ ਪਾਲਣ ਪੋਸ਼ਣ ਹੈ ਉਹ ਵੀ ਪੰਜਾਬੀ ਢੰਗ ਨਾਲ ਹੋਇਆ ਅਤੇ ਮਤਲਬ ਮੇਰੇ ਘਰ ਦੇ ਘਰ ਦੇ ਮੈਂਬਰਸ ਕੁਛ ਕੁ ਫੈਮਿਲੀ ਮੈਂਬਰ ਹੈ ਜਿਹੜੇ ਉਹ ਪੰਜਾਬੀ ਟੀਚਰ ਨੇ ਅਤੇ ਇਹਦੇ ਕਰਕੇ ਮੈਨੂੰ ਕਦੇ ਕੋਈ ਮੁਸ਼ਕਲ ਨਹੀਂ ਆਈ ਅਤੇ ਜਿਹੜੇ ਫੇ ਇਨ ਜਦੋਂ ਛੋਟੇ ਹੁੰਦਿਆਂ ਤੋਂ ਹੀ ਫੇਰ ਜਿਹੜੀ ਪੰਜਾਬੀ ਹੈ ਉਹ ਸਾਡੀ ਮਾਂ ਬੋਲੀ ਹੈ ਅਤੇ ਛੋਟੇ ਹੁੰਦਿਆਂ ਤੋਂ ਹੀ ਸਾਨੂੰ ਪੰਜਾਬੀ ਸਿਖਾਈ ਗਈ ਹੈ ਅਤੇ ਇਸ ਕਰਕੇ ਸਾਨੂੰ ਬੋਲਣ ਜਾਂ ਲਿਖਣ ਵਿੱਚ ਕਦੇ ਕੋਈ ਮੁਸ਼ਕਲ ਨਹੀਂ ਆਈ